ਪੰਜਾਬ ਵਿੱਚ ਜਿਹੜਾ ਪਹਿਲਾਂ ਕਲਚਰ ਸੀਗਾ ਉਹਦੇ ਵਿੱਚ ਪੰਜਾਬ ਦੀਆਂ ਪੁਰਾਣੀਆਂ ਬੁੜੀਆਂ ਦਰੀਆਂ ਬੁਣਦੀਆਂ ਸੀ ਫ਼ੁਲਕਾਰੀਆਂ ਬਣਾਉਂਦੀਆਂ ਸੀਗੀਆਂ ਪੀੜੀਆਂ ਬੁਣਦੀਆਂ ਸੀ ਸੂਤ ਕੱਤਦੀਆਂ ਸੀ ਦਰੀਆਂ ਬਣਾਉਂਦੀਆਂ ਸੀ ਗਲੋਟੇ ਬਣਾਉਂਦੀਆਂ ਸੀ ਮੰਜੇ ਬੁਣਦੀਆਂ ਸੀਗੀਆਂ ਸੂਤ ਰੰਗਦੀਆਂ ਸੀ ਮੰਜਿਆਂ ਨਾਲ ਬੰਨ੍ਹ ਕੇ ਨਾਲੇ ਬਣਾਉਂਦੀਆਂ ਸੀਗੀਆਂ ਕਾਨ੍ਹਿਆਂ ਨਾਲ ਅਤੇ ਪਹਿਲਾਂ ਹਰੇਕ ਚੀਜ਼ ਘਰੇ ਤਿਆਰ ਕੀਤੀ ਜਾਂਦੀ ਸੀਗੀ ਅੱਜ ਕੱਲ੍ਹ ਸਾਰਾ ਕੁਝ ਆਰਟੀਫਿਸ਼ਲ ਹੋ ਗਿਆ ਪਹਿਲਾਂ ਪੁਰਾਣੀਆਂ ਬੁੱਢੀਆਂ ਰੋਟੀ ਪਕਾਉਣ ਤੋਂ ਬਾਅਦ ਫਰੀ ਹੋ ਕੇ ਖੱਡੀ 'ਤੇ ਬਹਿੰਦੀਆਂ ਸੀ ਅਤੇ ਉਹਦੇ ਖੱਡੀ ਦੇ ਵਿੱਚ ਦਰੀਆਂ ਬੁਣੀਆਂ ਜਾਂਦੀਆਂ ਸੀਗੀਆਂ ਅਤੇ ਕੱਢਾਈਆਂ ਚਾਦਰਾਂ 'ਤੇ ਕੱਢਾਈਆਂ ਕੀਤੀਆਂ ਜਾਂਦੀਆਂ ਸੀਗੀਆਂ ਫੁੱਲ ਬੂਟੀਆਂ ਵਾਹੁੰਦੇ ਸੀਗੇ ਨਵੇਂ ਨਵੇਂ ਡਿਜ਼ਾਈਨ ਦੇ ਬੈੱਡਾਂ ਬੈੱਡਾਂ ਦੀਆਂ ਚਾਦਰਾਂ ਤਿਆਰ ਕੀਤੀਆਂ ਜਾਂਦੀਆਂ ਸੀਗੀਆਂ ਮੰਜਿਆਂ 'ਤੇ ਕੱਪੜਾ ਲਾਉਂਦੇ ਸੀਗੇ ਅਤੇ ਪੀੜੀਆਂ 'ਤੇ ਕੱਪੜਾ ਲਾਉਂਦੇ ਸੀ ਪਹਿਲਾਂ ਜਿਹੜੀਆਂ ਬੁੱਢੀਆਂ ਸੀਗੀਆਂ ਸਭ ਜਿੰਨੇ ਵੀ ਕਲਾ ਸੀਗੀ ਸਾਰੀ ਹਰੇਕ ਪਿੰਡ ਪੰਜਾਬ ਦੇ ਵਿੱਚ ਹਰੇਕ ਘਰੇ ਹੁੰਦੀ ਸੀਗੀ ਹਰੇਕ ਚੀਜ਼ ਆਪ ਘਰ ਹੀ ਬਣਾ ਲੈਂਦੀਆਂ ਸੀ ਅੱਜ ਕੱਲ੍ਹ ਸਾਰਾ ਕੁਛ ਆਰਟੀਫਿਸ਼ਲ ਹੋ ਗਿਆ ਪਹਿਲਾਂ ਸਭ ਕੁਛ ਪਿਓਰ ਦੇਸੀ ਸੀਗਾ